ਹੈਲੋ ਸਤਿ ਸ਼੍ਰੀ ਅਕਾਲ ਦੀਦੀ ਹਾਂਜੀ ਠੀਕ ਆ ਜੀ ਤੁਸੀਂ ਕਿਵੇਂ ਹੋ ਜੀ ਹਾਂਜੀ ਬੱਚੇ ਠੀਕ ਨੇ ਜੀ ਹਾਂ ਹੁਣ ਪੜ੍ਹਾਈ ਪੁੜਾਈ ਕਿਵੇਂ ਚੱਲਦੀ ਹੈ ਜੀ ਜਵਾਕਾਂ ਦੀ ਅੱਛਾ ਵਧੀਆ ਚੱਲਦੀ ਆ ਹੁਣ ਮੈਂ ਵੀ ਜਵਾਕਾਂ ਨੂੰ ਲਿਆ ਪੜ੍ਹਾਉਣਾ ਹੈਗਾ ਜੀ ਲਾਉਣਾ ਸੀ ਲਾਉਣਾ ਸੀ ਸਕੂਲ ਕਿਹੜੇ ਸਕੂਲ ਵਧੀਆ ਹੈਗਾ ਜੀ ਓਕੇ ਅੱਛਾ ਜੀ ਹੁਣ ਹਾਂ ਧਿਆਨ ਧਿਉਨ ਕਿਵੇਂ ਦਿੰਦੇ ਹੈ ਜਵਾਕਾਂ 'ਤੇ ਧਿਆਨ ਨਹੀਂ ਦਿੰਦੀਆਂ ਪੜ੍ਹਾਉਂਦੀਆਂ ਘੱਟ ਆ ਐਂਵੇ ਬਦਲਾਉਣਾ ਸਕੂਲ ਨੇ ਜਵਾਕਾਂ ਨੂੰ ਅੱਛਾ ਜੀ

ਅੱਛਾ ਅੱਛਾ ਜੀ ਹਾਂਜੀ ਹਾਂ ਅੱਛਾ ਜੀ ਅੱਛਾ ਜੀ ਹਾਂ ਲਾਣ ਅੱਛਾ ਹਾਂ ਹਾਂ

ਹਾਂ ਕੁੜੀ ਵੀ ਲਾਉਣੀ ਆ ਦੋਵੇਂ ਹੀ ਲਾਉਣਾ ਹੈਗੇ ਅੱਛਾ ਅੱਛਾ ਹਾਂ ਲਾ ਦੇਵਾਂਗੇ ਕੁੜੀ ਨੂੰ ਅੱਛਾ ਉੱਥੇ ਉੱਥੇ ਲਾ ਦਿਆਂ ਫਿਰ ਅੱਛਾ ਉਥੇ ਅੱਛਾ ਜੀ ਖਾਣਾ ਖੁਣਾ ਵੀ ਦਿੰਦੇ ਆ ਪੜ੍ਹਾਈ ਵਧੀਆ ਕਰਾਉਂਦੇ ਆ ਅੱਛਾ ਅੱਛਾ ਕੇਅਰ ਕਰਦੇ ਆ ਵਧੀਆ ਹੈਂ ਅਤੇ ਐਡਰੈਸ ਅੱਛਾ ਅਤੇ ਡਰੈਸ ਵਗੈਰਾ ਦਿੰਦੇ ਹੋਣਗੇ ਅੱਛਾ ਲੱਗੀ ਓਕੇ ਠੀਕ ਹੈ ਸਰ